ਅੱਜ ਕੱਲ ਦੀ ਪੜ੍ਹੀ ਲਿਖੀ ਨੌਜਵਾਨ ਪੀੜੀ ਨੌਕਰੀ ਪੇਸ਼ੇ ਨਾਲੋਂ ਆਪਣਾ ਕਾਰੋਬਾਰ ਕਰਨਾ ਜ਼ਿਆਦਾ ਪਸੰਦ ਕਰਦੀ ਹੈ ਜਿਵੇਂ ਅੱਜ ਕੱਲ ਨੌਜਵਾਨਾਂ ਦਾ ਪੋਲਟਰੀ ਫਾਰਮ ਵਿੱਚ ਵੀ ਰੁਝਾਨ ਵੱਧ ਰਿਹਾ ਹੈ ਹਾਲ ਈ ਦੇ ਵਿੱਚ ਸਾਲਾਂ ਵਿੱਚ ਇਹ ਕਿੱਤਾ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਪ੍ਰਫੁੱਲਤ ਹੋਇਆ ਹੈ ਅੱਜ ਕੱਲ ਜਿਵੇਂ ਮੱਛੀ ਪਾਲਣਾ ਮੁਰਗੀ ਪਾਲਣਾ ਸੂਰ ਪਾਲਣਾ ਆਦਿ ਇਹ ਕਿੱਤਿਆਂ ਵੱਲ ਵੀ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ ਕੁਝ ਲੋਕ ਮਾਸਾਹਾਰੀ ਹੁੰਦੇ ਹਨ ਉਹਨਾਂ ਕਰਕੇ ਇਹ ਕੀਤੇ ਪ੍ਰਫੁੱਲਤ ਹੁੰਦੇ ਹਨ ਕਿਉਂਕਿ ਲੋਕ ਖੁਸ਼ੀ ਦੇ ਮੌਕਿਆਂ ਤੇ ਤਿਉਹਾਰਾਂ ਅਤੇ ਵਿਆਹਵਾਂ ਤੇ ਜਨਮ ਦਿਨ ਆਦਿ ਮੌਕਿਆਂ ਤੇ ਸਿੰਪਲ ਸਾਦੇ ਭੋਜਨ ਦੇ ਨਾਲ ਨਾਲ ਨੋਨ ਵੈਜ ਯਾਨੀ ਕੇ ਮਾਸਾਹਾਰੀ ਭੋਜਨ ਵੀ ਖਾਨਾ ਪਸੰਦ ਕਰਦੇ ਹਨ ਕਈ ਲੋਕ ਆਮ ਤੌਰ ਤੇ ਨੋਨ ਵੈਜ ਖਾਨ ਦੇ ਸ਼ੌਂਕੀਨ ਹੁੰਦੇ ਹਨ ਉਹ ਆਪ ਇਹ ਚੀਜ਼ਾਂ ਖਰੀਦਦੇ ਰਹਿੰਦੇ ਹਨ ਇਹਨਾਂ ਕਰਕੇ ਪੋਲਟਰੀ ਫਾਰਮ ਦੇ ਕਿੱਤੇ ਪ੍ਰਫੁੱਲਤ ਹੁੰਦੇ ਹਨ ਕੁਝ ਕੁ ਲੋਕ ਸ਼ਾਕਾਹਾਰੀ ਹੁੰਦੇ ਹਨ ਉਹਨਾਂ ਕਰਕੇ ਇਹ ਕਿੱਤਾ ਪ੍ਰਭਾਵਿਤ ਤਾਂ ਹੁੰਦਾ ਹੈ ਪਰ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਅੱਜ ਕੱਲ ਜਿਵੇਂ ਕਿ ਹਰੇਕ ਮੌਕੇ ਤੇ ਖਿਡਾਰੀ ਜਾਂ ਆਮ ਲੋਕ ਆਪਨੀ ਰੋਜ ਦੇ ਜੀਵਨ ਵਿੱਚ ਮਾਸਾਹਾਰੀ ਭੋਜਨ ਖਾਣਾ ਪਸੰਦ ਕਰਦੇ ਹਨ ਸਭ ਤੋਂ ਵੱਧ ਮੰਗ ਵਾਲੇ ਉਤਪਾਦ ਜਿਵੇਂ ਮੱਛੀ ਮੁਰਗਾ ਬੱਕਰਾ ਆਦਿ ਦਾ ਮੀਟ ਖਾਣ ਦੇ ਲੋਕ ਸ਼ੌਂਕੀਨ ਹੁੰਦੇ ਹਨ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਇਹ ਚੀਜ਼ਾਂ ਖਾਣ ਲਈ ਡੋਕਟਰ ਵੀ ਸਲਾਹ ਦਿੰਦੇ ਹਨ ਕਿ ਉਹ ਮੀਟ ਆਂਡਾ ਮੱਛੀ ਮੁਰਗਾ ਬੱਕਰਾ ਸਾਡੀ ਆਪਣੇ ਭੋਜਨ ਵਿੱਚ ਸ਼ਾਮਲ ਕਰਨ ਤਾਂ ਕਿ ਉਹਨਾਂ ਦੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਵੇ ਅਤੇ ਉਹ ਹਮੇਸ਼ਾ ਸਿਹਤਮੰਦ ਰਹਿਣ ਇਸ ਕਰਕੇ ਇਸ ਕਿੱਤੇ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾਂਦਾ ਹੈ